ਹੈਲੋ ਸਤਿ ਸ੍ਰੀ ਅਕਾਲ ਦੀ ਹੋਰ ਕਿਵੇਂ ਔ ਮੈਨੂੰ ਨਾ ਦੀ ਸਰਪੰਚ ਦੇ ਘਰ ਤੇ ਇੱਕ ਫੋਰਮ ਆਇਆ ਤਾ ਤਾਂ ਉਹਨਾਂ ਨੇ ਤੀਆਂ ਬਾਰੇ ਦੱਸਿਆ ਕਿ ਮੈਂ ਗਿੱਧੇ 'ਚ ਭਾਗ ਲੈ ਰਹੀ ਹਾਂ ਤੁਸੀਂ ਲੈਣਾ ਹੈ ਹਾਂਜੀ ਠੀਕ ਹੈ ਆਪਾਂ ਹੈਗੀਆਂ ਦੀ ਦਸ ਬਾਰਾਂ ਕੁੜੀਆਂ ਔਰਗਨਾਈਜ ਦੀ ਸਰਪੰਚ ਹੀ ਕਰ ਰਿਹਾ ਪਿੰਡ ਦਾ ਅਤੇ ਗਿੱਧ ਗਿੱਧੇ ਲਈ ਇੱਕ ਡਾਂਸਰ ਭੇਜਣਗੇ ਓਹ ਮੋਹਾਲੀ ਤੋਂ ਆਊਗਾ ਉਹ ਉਹੀ ਆਪਾਂ ਨੂੰ ਸਾਰਾ ਕੁੱਝ ਸਿਖਾਊਗਾ ਹਾਂਜੀ ਟਾਈਮਿੰਗ ਦੀਦੀ ਸ਼ਾਮ ਨੂੰ ਹੋਊਗਾ ਪੰਜ ਵਜੇ ਵੈਸੇ ਪ੍ਰੈਕਟਿਸ ਪੰਜ ਵਜੇ ਹੋਊਗੀ ਔਰ ਇਹ ਸੰਡੇ ਨੂੰ ਹੋਵੇਗਾ ਫੈਸਟੀਵਲ ਹਾਂਜੀ ਠੀਕ ਹੈ ਦੀਦੀ ਮੈਂ ਘਰ ਆ ਕੇ ਦੱਸਦੀ ਠੀਕ ਹੈ ਠੀਕ ਹੈ ਬਾਏ ਦੀਦੀ